ਜਦੋਂ ਅਸੀਂ ਦੂਜੇ ਰਾਜ ਵਿੱਚ ਜਾਂਦੇ ਹਾਂ ਤਾਂ ਸਾਨੂੰ ਭਾਸ਼ਾ ਦੀ ਬੜੀ ਦਿੱਕਤ ਆਉਂਦੀ ਵਾ ਜਿੱਦਾਂ ਸਾਨੂੰ ਭਾਸ਼ਾ ਬੋਲਣੀ ਸਮਝਣੀ ਬੜੀ ਔਖੀ ਲੱਗਦੀ ਹੈ ਸਾਨੂੰ ਕੋਈ ਚੀਜ਼ ਮੰਗਣੀ ਹੋਵੇ ਤਾਂ ਸਾਨੂੰ ਉਹ ਚੀਜ਼ ਥੋੜ੍ਹੀ ਦਿੱਕਤਮੰਦ ਲੱਗਦੀ ਹੈ ਜਿੱਦਾਂ ਹੀ ਸਾਹਮਣੇ ਵਾਲੇ ਨੂੰ ਕੁਛ ਪੁੱਛਾਂਗੇ ਉਹਨੂੰ ਸਮਝ ਨਹੀਂ ਆਉਂਦਾ ਕਦੇ ਕਦੇ ਕਦੇ ਕਦੇ ਸਾਨੂੰ ਸਮਝ ਨਹੀਂ ਆਉਂਦਾ ਅਤੇ ਅਸੀਂ ਕੋਸ਼ਿਸ਼ ਕਰਦੇ ਜਿੱਦਾਂ ਇਸ਼ਾਰਿਆਂ ਨਾਲ ਸਮਝਾਈਏ ਪਰ ਸਾਨੂੰ ਕਦੇ ਕਦੇ ਐਪ ਦੀ ਲੋੜ ਵੀ ਲੈ ਸਕਦੇ ਹਾਂ ਮੈਂ ਕਦੇ ਲਈ ਨਹੀਂ ਪਰ ਓਦਾਂ ਮੈਂ ਜ਼ਿਆਦਾਤਰ ਇਸ਼ਾਰਿਆਂ ਨਾਲ ਸਮਝਾ ਸਕਦੇ ਹਾਂ ਜੇ ਤੁਹਾਡੇ ਤੁਹਾਨੂੰ ਲੱਗਦਾ ਕਿ ਤੁਸੀਂ ਇਸ਼ਾਰਿਆਂ ਨਾਲ ਸਮਝਾ ਦਿੰਦੇ ਹੋ ਅਤੇ ਇਸ਼ਾਰਿਆਂ ਨਾਲ ਹੀ ਸਮਝਾ ਸਕਦੇ ਹਾਂ ਨਹੀਂ ਤਾਂ ਸਾਨੂੰ ਐਪ ਦੀ ਵੀ ਜ਼ਰੂਰਤ ਪੈ ਸਕਦੀ ਆਂ ਅਤੇ ਐਪ ਇੱਕ ਬੜੀ ਵਧੀਆ ਚੀਜ਼ ਹੁੰਦੀ ਆ ਐਪ ਨਾਲ ਅਸੀਂ ਬੜੇ ਵਧੀਆ ਤਰੀਕੇ ਨਾਲ ਸਮਝਾ ਸਕਦੇ ਹਾਂ ਹਰੇਕ ਚੀਜ਼ ਨੂੰ ਅਤੇ ਇਸ਼ਾਰਿਆਂ ਨਾਲ ਅਸੀਂ ਕਈ ਚੀਜ਼ਾਂ ਸਮਝਾ ਸਕਦੇ ਹਾਂ ਕਈ ਚੀਜ਼ਾਂ ਅਸੀਂ ਵਧੀਆ ਤਰੀਕੇ ਨਾਲ ਨਹੀਂ ਸਮਝਾ ਸਕਦੇ ਤਾਂ ਇਸ ਲਈ ਸਾਨੂੰ ਇਸ਼ਾਰਿਆਂ ਵਿੱਚ ਆਪਣੀ ਗੱਲ ਵਧੀਆ ਸਮਝਾ ਸਕਦੇ ਹਾਂ ਅਤੇ ਦੂਜੇ ਸ਼ਹਿਰ ਜਾਣ 'ਚ ਉੱਦਾਂ ਬੜੀ ਤਕਲੀਫ ਹੁੰਦੀ ਹੈ ਵਗੈਰਾ ਵਗੈਰਾ ਠੀਕ ਹੈ